ਭੰਗੜੇ ਦੇ ਵਿੱਚ ਢੋਲ ਅਤੇ ਹੋਰ ਕਈ ਪੰਜਾਬੀ ਮਿਊਜਿਕ ਇੰਸਟਰੂਮੈਂਟਸ ਦੀ ਵਰਤੋਂ ਕੀਤੀ ਜਾਂਦੀ ਹੈ ਭੰਗੜਾ ਕਈ ਵਾਰ ਸਾਊਂਡ ਸਿਸਟਮ 'ਤੇ ਵੀ ਚਲਾਇਆ ਜਾਂਦਾ ਹੈ ਭੰਗੜੇ ਦੀ ਬੀਟ ਹਾਈ ਹੋਣ ਕਾਰਨ ਭੰਗੜੇ ਨੂੰ ਕਰਨ ਵਿੱਚ ਬਹੁਤ ਮਜ਼ਾ ਆਉਂਦਾ ਹੈ